ਹੈਲੋ ਦੋਸਤੋ ਮੈਨੂੰ ਤੈਨੂੰ ਬਹੁਤ ਬਹੁਤ ਧੰਨਵਾਦ ਕਿਉਂਕਿ ਤੂੰ ਮੈਨੂੰ ਇਸ ਫਿਲਮ ਲਈ ਸੱਦਾ ਪੱਤਰ ਭੇਜਿਆ ਪਰ ਮੇਰੇ ਦੋਸਤ ਮੈਨੂੰ ਇਸ ਫਿਲਮ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਤੇ ਇਸ ਦੀਆ ਘਟਨਾਵਾਂ ਬਾਰੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਤੂੰ ਅਗਰ ਮੈਨੂੰ ਇਸ ਫਿਲਮ ਦੇ ਬਾਰੇ ਕੁਝ ਦੱਸੇਗਾ ਤੇ ਘਟਨਾਵਾਂ ਬਾਰੇ ਦੱਸੇਗਾ ਤਾਂ ਮੈਂ ਇਹ ਫਿਲਮ ਦੇਖਣ ਵਿੱਚ ਪੂਰੀ ਦਿਲਚਸਪੀ ਲਊਂਗਾ ਤੇ ਇਹ ਫਿਲਮ ਪੂਰੀ ਦਿਲਚਸਪੀ ਨਾਲ ਦੇਖੂਗਾ ਇਹ ਫੈਸਲਾ ਕਰਦਾ ਹਾਂ ਕਿ ਮੈਂ ਫਿਲਮ ਦਾ ਸਿਰਲੇਖ ਸੰਕੇਪ ਅਤੇ ਮਿਤੀ ਅਤੇ ਸਥਾਨ ਵਰਗੇ ਵੇਰਵਿਆਵਾਂ ਲਈ ਤੇਤੋਂ ਜਾਣਕਾਰੀ ਚਾਹੁੰਦਾ ਹਾਂ ਤੂੰ ਮੈਨੂੰ ਇਹ ਦੱਸ ਕਿ ਇਹ ਫਿਲਮ ਵਿੱਚ ਕੀ ਘਟਨਾਵਾਂ ਹਨ ਤੇ ਕੀ ਕੁਝ ਹੈ ਤਾਂ ਕੀ ਮੈਂ ਇਹ ਫਿਲਮ ਪੂਰੀ ਦਿਲਚਸਪੀ ਨਾਲ ਦੇਖਾਂ ਅਤੇ ਇਸ ਵਿੱਚ ਰੁਚੀ ਲਵਾਂ ਮੈਨੂੰ ਇਹ ਦੱਸ ਇਸ ਫਿਲਮ ਦਾ ਸਿਰਲੇਖ ਸੰਖੇਪ ਮਿਤੀ ਅਤੇ ਸਮਾਂ ਤੇ ਸਥਾਨ ਕਿਹੜੇ ਕਿੱਥੇ ਹੈ ਤੇ ਕਿਵੇਂ ਹੈ ਇਸਨੂੰ ਫਿਲਮ ਵਿੱਚ ਕੀ ਕੁਛ ਹੈ ਕਿਹੜੀਆਂ ਘਟਨਾਵਾਂ ਅਤੇ ਹਨ ਇਹ ਕੋਈ ਇਤਿਹਾਸਿਕ ਜਾਂ ਇਤਿਹਾਸਿਕ ਯਾਂ ਮਿਥਿਹਾਸਿਕ ਘਟਨਾਵਾਂ ਹਨ ਜਾ ਕੋਈ ਇਹੋ ਜਿਹੀ ਫਿਲਮਾਂ ਹਨ ਜਿਸ ਵਿੱਚ ਮੈਨੂੰ ਬਹੁਤ ਸਾਰੀ ਗਿਆਨ ਮਿਲੂਗਾ ਤੇ ਗਿਆਨ ਦੀ ਪੂਰਤੀ ਹੋਗੀ ਮੈਂ ਇਹ ਤੇਰੀ ਫਿਲਮ ਬਹੁਤ ਹੀ ਦਿਲਚਸਪੀ ਨਾਲ ਦੇਖੂੰਗਾ ਤੇ ਤੇਰਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੋ ਕਿ ਤੂੰ ਮੈਨੂੰ ਇਹ ਫਿਲਮ ਨੂੰ ਸੱਦਾ ਪੱਤਰ ਭੇਜਿਆ ਮੈਂ ਤੇਰਾ ਬਹੁਤ ਧੰਨਵਾਦੀ ਆਂ ਇਹ ਫਿਲਮ ਹੈ ਸਕਰੀਨਿੰਗ ਜਿੱਥੇ ਤੂੰ ਵਿਖਾਣਾ ਚਾਹੇਗਾ ਮੈਂ ਉੱਥੇ ਹੀ ਆ ਕੇ ਵੇਖ ਲਊਂਗਾ ਮੈਨੂੰ ਇਸ ਫਿਲਮ ਦਾ ਸਿਰਲੇਖ ਸੰਖੇਪ ਮਿਤੀ ਸਮਾਂ ਅਤੇ ਸਥਾਨ ਦੱਸ ਕੇ ਮੈਨੂੰ ਉੱਥੇ ਪਹੁੰਚਣ ਦੀ ਮਦਦ ਕਰ ਤਾਂ ਕੀ ਮੈਂ ਤੇਰੀ ਫਿਲਮ ਨੂੰ ਪੁਰੀ ਦਿਲਚਸਪੀ ਨਾਲ ਦੇਖ ਕੇ ਤੇਰਾ ਮਾਨ ਰੱਖਾਂ